ਪਹਿਲੇ ਟਾਈਮ ਵਿੱਚ ਕੱਪੜੇ ਸੀਣੇ ਬੜੇ ਔਖੇ ਲੱਗਦੇ ਸੀ ਹੱਥ ਨਾਲ ਮਸ਼ੀਨ ਚਲਾ ਚਲਾ ਕੇ ਸਾਰਾ ਦਿਨ ਚ ਇੱਕ ਸੂਟ ਮਸਾ ਸੀਤਾ ਜਾਂਦਾ ਸੀਗਾ ਹੌਲੀ ਹੌਲੀ ਪੈਰਾਂ ਵਾਲੀ ਮਸ਼ੀਨ ਆਈ ਬੰਦਾ ਦੋ ਸੂਟ ਸੀਨ ਲੱਗ ਗਿਆ ਚਲੋ ਤਰਪਾਈਆਂ ਕਿਸੀ ਤੋਂ ਕਰਵਾ ਲਈਆਂ ਸੂਟ ਅਸੀਂ ਆਪ ਸੀਣ ਲਏ ਫਿਰ ਹੌਲੀ ਹੌਲੀ ਪੈਰਾਂ ਵਾਲੀ ਮਸ਼ੀਨ ਤੇ ਮੋਟਰ ਲੱਗਣ ਲੱਗ ਗਈ ਮੋਟਰ ਲਗਾਈ ਤੇ ਫਾਇਦਾ ਬਹੁਤ ਹੋ ਗਿਆ ਚਲ ਪਹਿਲਾ ਦੋ ਸੂਟ ਸੀਦੇ ਸੀ ਦਿਨ ਚ ਫਿਰ ਤਿੰਨ ਸੀਣ ਲੱਗ ਗਏ ਤੇ ਤਰਪਾਈਆਂ ਬਾਹਰੋਂ ਕਰਵਾ ਲਈਆਂ ਫਿਰ ਫੈਸ਼ਨ ਡਿਜ਼ਾਇਨਿੰਗ ਦੀਆਂ ਮਸ਼ੀਨਾਂ ਆ ਗਈਆਂ ਕੋਈ ਕਢਾਈ ਹੋ ਗਈ ਕੋਈ ਬਟਨ ਲਗਾਣ ਵਾਲੀ ਮਸ਼ੀਨ ਆ ਗਈ ਕਰਦੇ ਕਰਦੇ ਸਾਨੂੰ ਪ੍ਰੋਫਿਟ ਹੁੰਦਾ ਗਿਆ ਹੁੰਦਾ ਗਿਆ ਅਸੀਂ ਅੱਗੇ ਵਧਦੇ ਗਏ ਫਿਰ ਅੱਗੇ ਇੱਕ ਦੀਆਂ ਦੋ ਮਸ਼ੀਨਾਂ ਲਾ ਲਈਆਂ ਫਿਰ ਹੈਲਪਰ ਰੱਖ ਲਏ ਅਸੀਂ ਹੈਲਪਰ ਰੱਖਣਾ ਸਾਨੂੰ ਹੋਰ ਥੋੜਾ ਬੈਨੀਫਿਟ ਹੋਣ ਲੱਗ ਗਿਆ ਦੋ ਤੋ ਅਸੀਂ ਚਾਰ ਸੂਟ ਸੀਨ ਲੱਗ ਗਏ ਚਾਰ ਸੂਟ ਕਰਦੇ ਕਰਦੇ ਅਸੀਂ ਆਪਣਾ ਬੁਟੀਕ ਬਣਾਇਆ ਹੁਣ ਅਸੀਂ ਬਹੁਤ ਅੱਛੇ ਚੱਲ ਰਹੇ ਹੈਗੇ ਆਂ ਮਤਲਬ ਸਾਡੇ ਕੋਲ ਪਹਿਲਾਂ ਇੱਕ ਮਸ਼ੀਨ ਸੀ ਹੱਥ ਵਾਲੀ ਸੀਗੀ ਹੌਲੀ ਹੌਲੀ ਪੈਰਾਂ ਵਾਲੀ ਲਈ ਕਰਦੇ ਕਰਦੇ ਅਸੀਂ ਇਲੈਕਟ੍ਰਿਕ ਮੋਟਰ ਲਗਾਈ ਮੋਟਰ ਲਗਾਣ ਤੋਂ ਬਾਅਦ ਅਸੀਂ ਚਾਰ ਮਸ਼ੀਨਾਂ ਕਰਕੇ ਅੱਗੇ ਹੈਲਪਰ ਰੱਖੇ ਟੇਲਰ ਵੀ ਰੱਖੇ ਕਟਿੰਗ ਮੈ ਕਰਦੀ ਆਂ ਟੇਲਰ ਕੋਈ ਹੋਰ ਕਰਦਾ ਚਲੋ ਅਸੀਂ ਇਸ ਤਰਾਂ ਆਪਣਾ ਬਿਜਨਸ ਵਧਾ ਲਿਆ